ਮੈਂ ਨੇੜਲੇ ਕਸਬਿਆਂ ਪਿੰਡਾਂ ਦਾ ਦੌਰਾ ਕਰਦੀ ਹੀ ਰਹਿੰਦੀ ਹਾਂ ਦੋ ਤਿੰਨ ਦਿਨ ਬਾਅਦ ਚਲੇ ਹੀ ਜਾਨੀ ਹਾਂ ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗੇ ਇਹ ਚੀਜ਼ਾਂ ਕੀ ਹੈਗੀਆਂ ਨੇ ਉਹਨਾਂ ਨੂੰ ਦਿਖਾਉਣ ਲਈ ਵੀ ਲੈ ਕੇ ਜਾਨੀ ਹਾਂ ਉਹਨਾਂ ਜਿਵੇਂ ਦਰੱਖਤ ਹੈਗੇ ਆ ਉੱਥੇ ਤਾਜ਼ੀ ਹਵਾ ਹੈ ਅਤੇ ਇੱਥੇ ਤਾਂ ਸ਼ਹਿਰਾਂ ਵਿੱਚ ਤਾਂ ਬਹੁਤ ਜ਼ਿਆਦਾ ਪ੍ਰਦੂਸ਼ਣ ਹੈਗਾ ਅਤੇ ਪਿੰਡਾਂ ਦੇ ਵਿੱਚ ਤਾਜ਼ੀ ਹਵਾ ਕਸਰਤ ਕਰਦਾ ਬੰਦਾ ਬਾਕੀ ਮੈਂ ਬੱਚਿਆਂ ਨੂੰ ਲੈ ਕੇ ਜਾਨੀ ਹਾਂ ਬੱਚਿਆਂ ਨੂੰ ਉੱਥੇ ਦਿਖਾਈਦੇ ਆ ਜਿਵੇਂ ਝੂਲੇ ਉਹ ਬੱਚੇ ਦੇਖ ਕੇ ਖੁਸ਼ ਹੁੰਦੇ ਹਨ ਵੱਡੇ ਵਡੇਰੇ ਹੁੰਦੇ ਆ ਜਿਵੇਂ ਉੱਥੇ ਉਹਨਾਂ ਦੇ ਨਾਲ ਗਾਵਾਂ ਮੱਝਾਂ ਤਾਜ਼ਾ ਦੁੱਧ ਹਰ ਇੱਕ ਚੀਜ਼ ਨਵੀਂ ਫਰੈਸ਼ ਸਭ ਕੁਝ ਉੱਥੇ ਹੁੰਦਾ ਹੈ ਜੋ ਚੀਜ਼ਾਂ ਇੱਥੇ ਆਮ ਸ਼ਹਿਰਾਂ ਦੇ ਵਿੱਚ ਨਹੀਂ ਹੁੰਦੀਆਂ ਉਹ ਚੀਜ਼ਾਂ ਉੱਥੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਹੁੰਦੀਆਂ ਹਨ ਅਤੇ ਮੇਰਾ ਬੱਚਿਆਂ ਨੂੰ ਲੈ ਕੇ ਜਾਣ ਦਾ ਉਦੇਸ਼ ਵੀ ਇਹੀ ਹੁੰਦਾ ਹੈ ਕਿ ਬੱਚੇ ਸਾਡੇ ਉਹਦੇ ਨਾਲ ਜੁੜੇ ਰਹਿਣ ਕਲਚਰ ਦੇ ਨਾਲ ਜੁੜੇ ਰਹਿਣ ਪੰਜਾਬੀ ਸੱਭਿਅਤਾ ਸੱਭਿਅਤਾ ਦੇ ਨਾਲ ਜੁੜੇ ਰਹਿਣ ਉਹਨਾਂ ਦੇ ਵਿੱਚ ਪੰਜਾਬੀਅਤ ਪੈਦਾ ਹੋਵੇ ਕਿ ਹਾਂਜੀ ਜੀ ਅਸੀਂ ਪੰਜਾਬੀ ਹੈਗੇ ਹਾਂ ਸਾਡੇ ਵੱਡੇ ਕਿੱਦਾਂ ਦੇ ਸੀ ਸਾਡੇ ਪਿੰਡਾਂ ਪਿੰਡ ਕਿੱਦਾਂ ਦੇ ਨੇ ਹਰ ਇੱਕ ਚੀਜ਼ ਬੱਚਿਆਂ ਨੂੰ ਸਿਖਾਏ ਬੰਦਾ ਆਦਰ ਕਰਨਾ ਸਿਖਾਉਂਦਾ ਵੱਡੇ ਹੁੰਦੇ ਉੱਤੇ ਪੈਰੀ ਪੈਣਾ ਕੀਤਾ ਸਾਰੀਆਂ ਚੀਜ਼ਾਂ ਬੜਾ ਵਧੀਆ ਲੱਗਦਾ ਹੈ ਬੱਚੇ ਜਦੋਂ ਇੱਦਾਂ ਕਰਦੇ ਹਨ ਅਤੇ